ਸਤਿ ਸ਼੍ਰੀ ਅਕਾਲ ਮੈਂ ਅਮਨਪ੍ਰੀਤ ਕੌਰ ਪਠਾਨਕੋਟ ਤੋਂ ਗੱਲ ਕਰਦੀ ਪਈ ਹਾਂ ਜਿਵੇਂ ਕਿ ਸਾਡੇ ਪੰਜਾਬ ਦੇ ਇਲਾਕੇ ਵਿੱਚ ਵੱਖ ਵੱਖ ਤਰੀਕੇ ਦੀ ਰਸਮਾਂ ਵੱਖ ਵੱਖ ਮੌਕੇ ਉੱਤੇ ਕਈ ਕੀਤੀਆਂ ਜਾਂਦੀਆਂ ਹਨ ਇਹਨਾਂ ਵਿੱਚੋਂ ਇੱਕ ਰਸਮ ਹੈ ਪਾਣੀ ਵਾਰਨ ਦੀ ਜਦੋਂ ਵਿਆਹ ਕੇ ਮੁੰਡਾ ਆਪਣੀ ਲਾੜੀ ਨੂੰ ਲੈ ਕੇ ਆਪਣੇ ਘਰ ਪਹੁੰਚਦਾ ਹੈ ਸਭ ਤੋਂ ਪਹਿਲੀ ਰਸਮ ਉਸਦੀ ਮਾਂ ਮ ਲਾੜੀ ਤੋਂ ਆਪਣੇ ਆਪਣੇ ਪੁੱਤ ਨਹੁੰ ਤੋਂ ਪਾਣੀ ਵਾਰ ਕੇ ਉਹਨਾਂ ਦੀ ਬਲਾਵਾਂ ਲਾਹੁੰਦੀ ਹੈ ਫਿਰ ਮੂੰਹ ਦੇਖਣ ਦੀ ਰਸਮ ਜਦੋਂ ਸਾਡੇ ਇੱਥੇ ਨਵੀਂ ਲਾੜੀ ਆਉਂਦੀ ਹੈ ਤਾਂ ਉਹਦਾ ਲ ਲਾਗੇ ਭਾਈਚਾਰੇ ਦੀ ਔਰਤਾਂ ਜਿਹੜੀ ਨਵੀਂ ਨਵੀਂ ਲਾੜੀ ਨੂੰ ਸ਼ਗਨ ਪਾਉਂਦੀਆਂ ਹੈ ਅਤੇ ਲਾੜੀ ਦਾ ਮੂੰਹ ਦੇਖਦੀਆਂ ਹਨ ਫਿਰ ਪੂਜਾ ਅਤੇ ਫਿਰ ਸ ਪ ਪੂਜਾ ਕਰਵਾਉਂਦੀਆਂ ਹਨ ਜਿਹੜੀ ਕਿ ਵਿਆਹ ਤੋਂ ਅਗਲੇ ਦਿਨ ਸਵੇਰੇ ਆਪਣੇ ਜਠੇਰਿਆਂ ਦੇ ਜਾ ਕੇ ਅਤੇ ਜਠੇਰਿਆਂ ਦੀ ਪੂਜਾ ਕਰਕੇ ਆਉਂਦੇ ਹਨ ਪੇਟੀ ਖੋਲ੍ਹਣਾ ਫਿਰ ਜਦੋਂ ਸ ਜਿਹੜਾ ਦਾਜ ਆਉਂਦਾ ਦਾਜ ਦੀ ਜਿਹੜੀ ਪੇਟੀ ਖੋਲ੍ਹਦੀਆਂ ਹਨ ਉਸਦੇ ਭਾਈਚਾਰੇ ਦੀਆਂ ਅਤੇ ਪਿੰਡ ਦੀਆਂ ਔਰਤਾਂ ਜਿਹੜੀਆਂ ਔਰਤਾਂ ਉਹ ਦਿਖਾਵਾ ਪਾਉਂਦੀਆਂ ਹਨ ਫਿਰ ਉਹਨਾਂ ਵਿੱਚੋਂ ਜਦੋਂ ਕਿ ਸਾਡੇ ਪੰਜਾਬ ਵਿੱਚ ਮੁੰਡਾ ਜੰਮਦਾ ਹੈ ਤਾਂ ਉਹ 'ਤੇ ਲੋਹੜੀ ਪਾਉਂਦੇ ਹਨ ਇਹ ਵੀ ਇੱਕ ਬੜੀ ਵਧੀਆ ਰਸਮ ਹੁੰਦੀ ਹੈ ਅਤੇ ਉਹਦਾ ਹਿੰਦੂ ਪਰਿਵਾਰ ਦੇ ਵਿੱਚ ਤਾਂ ਬੱਚੇ ਦਾ ਬੜਾ ਬ ਮੁੰਡਣ ਕਰ ਮੁੰਡਣ ਕਰਦੇ ਹਨ ਜਿਹੜਾ ਹੈਗਾ ਸਿੱਖ ਪਰਿਵਾਰ ਉਹ 'ਚ ਅੰਮ੍ਰਿਤ ਛਕਾਉਂਦੇ ਹਨ ਅਤੇ ਮੁਸਲਮਾਨ ਜਿਹੜੇ ਉਹ ਸੁੰਨਤ ਕਰਦੇ ਹਨ ਅਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਇੱਕ ਜਿਹੜੇ ਪੰਜਾਬੀ ਜਿਹੜੇ ਹੈ ਸਿੱਖ ਲੋਕ ਆ ਉਹਨਾਂ ਦਾ ਜਿਹੜਾ ਵਿਆਹ ਹੁੰਦਾ ਉਹ ਫੇਰਿਆਂ ਦੇ ਨਾਲ ਹੁੰਦਾ ਵਾ ਜਿਹੜੇ ਨਾਲ ਜਿਹੜੇ ਆਨੰਦ ਕਾਰਜ ਕਰਦੇ ਹਨ ਜਿਹੜੇ ਹਿੰਦੂ ਲੋਕ ਆ ਉਹ ਫੇਰੇ ਕਰਦੇ ਹਨ ਮੁਸਲਮਾਨ ਲੋਕ ਉਹ ਨਿਕਾਹ ਅਦਾ ਕਰਦੇ ਹਨ ਨਿਕਾਹ ਦੀ ਰਸਮ ਅਦਾ ਕਰਦੇ ਹਨ ਜਿਹੜੇ ਇਹ ਸਾਡੇ ਪੰਜਾਬ ਵਿੱਚ ਦੀ ਰਸਮਾਂ ਵਾਂ ਇਹ ਵੱਖ ਵੱਖ ਮੌਕੇ ਤੋਂ ਸਾਡੇ ਜੰਮਣ ਤੋਂ ਲੈ ਕੇ ਸਾਡੇ ਜਿਹੜੇ ਮਰਨ ਤੱਕ ਜਿਹੜੀ ਸਾਡੀਆਂ ਰਸਮਾਂ ਉਹ ਵੱਖ ਵੱਖ ਤਰ੍ਹਾਂ ਦੇ ਰਸਮਾਂ ਉਹ ਨਿਭਾਈਆਂ ਜਾਂਦੀਆਂ ਹਨ ਜਿਵੇਂ ਕਿ ਬੱਚਾ ਜਦੋਂ ਜੰਮਦਾ ਹੈ ਤਾਂ ਉਸ ਨੂੰ ਸ਼ਹਿਦ ਸ਼ਹਿਦ ਚਟਾਉਂਦੇ ਹਨ ਫਿਰ ਉਸਦਾ ਜਿਹੜਾ ਨਾਮਕਰਨ ਨਾਮਕਰਨ ਕਰਦੇ ਹਨ ਫੇਰ ਥੋੜ੍ਹਾ ਜਿਹਾ ਜਦ ਬੱਚਾ ਸਾਲ ਦਾ ਹੋ ਜਾਂਦਾ ਫੇਰ ਉਹਦੇ ਜਿਹੜਾ ਮੂੰਹ ਨੂੰ ਅਨਾ ਅਨਾਜ ਅਨਾਜ ਲਾ ਕੇ ਅਤੇ ਉਹਨੂੰ ਕਹਿ ਦਿੰਦੇ ਕਿ ਨੂੰ ਅੱਜ ਇਹ ਖ ਅੱਜ ਤੋਂ ਅਨਾਜ ਖਾਣ ਲੱਗ ਪਵੇਗਾ ਅਤੇ ਉਹ ਅਨਾਜ ਰਸਮ ਕਰਦੇ ਹਨ ਜਿਹੜੀਆਂ ਮਤਲਬ ਕਿ ਜਿਹੜੀਆਂ ਸਾਡੀਆਂ ਰਸਮਾਂ ਵਾਂ ਇਹ ਸਾਡੇ ਜ ਮਨੁੱਖੀ ਜਿਹੜੀ ਜੀਵਨ ਦੇ ਵਿੱਚ ਹੈ ਸਾਡੇ ਜੀਣ ਤੋਂ ਲੈ ਕੇ ਸਾਡੇ ਮਤਲਬ ਕਿ ਮਰਨ ਤੱਕ ਜਿਹੜੀ ਸਭ ਰਸਮਾਂ ਇਹ ਵੱਖ ਵੱਖ ਮੌਕੇ ਉੱਤੇ ਨਿਭਾਈਆਂ ਜਾਂਦੀਆਂ ਹਨ